ਅੱਜ ਕੱਲ੍ਹ ਪੇਂਡੂ ਲੋਕਾਂ ਨੇ ਆਪਣੇ ਵਿਰਾਸਤੀ ਸਮਾਨ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਹਾਂ ਜਿਵੇਂ ਪਹਿਲਾਂ ਪਿੱਤਲ ਦੇ ਭਾਂਡਿਆਂ 'ਚ ਹੀ ਖਾਣਾ ਬਣਾਇਆ ਜਾਂਦਾ ਸੀ ਪਰੋਸਿਆ ਜਾਂਦਾ ਸੀ ਉਹਦੇ ਵਿੱਚ ਹੀ ਖਾਇਆ ਜਾਂਦਾ ਸੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਪਿੱਤਲ ਦੇ ਭਾਂਡੇ ਵਿੱਚ ਜਮਸ ਘੱਟ ਹੁੰਦੇ ਹਨ ਅਤੇ ਉਹ ਐਜ ਕੰਪੇਅਰ ਟੂ ਸਟੀਲ ਦੇ ਭਾਂਡਿਆਂ ਨਾਲੋਂ ਵੀ ਵਧੀਆ ਮਜ਼ਬੂਤ ਅਤੇ ਲਾਭਦਾਇਕ ਹੁੰਦੇ ਹਨ ਅਤੇ ਇਸ ਤਰ੍ਹਾਂ ਉਹ ਬਹੁਤ ਹੀ ਲਾਭ ਕਮਾ ਰਹੇ ਹਨ ਅਤੇ ਸਾਡੇ ਖੇਤਰ ਵਿੱਚ ਇੱਕ ਇੱਦਾਂ ਦਾ ਕਾਰੋਬਾਰ ਸ਼ੁਰੂ ਹੋਇਆ ਹੈ ਜੋ ਪੁਰਾਣੇ ਪਿੱਤਲ ਦੇ ਭਾਂਡੇ ਹਨ ਉਹਨਾਂ ਨੂੰ ਦੁਬਾਰਾ ਯੂਸ 'ਚ ਲਿਆ ਕੇ ਵੇਚਿਆ ਜਾ ਰਿਹਾ ਹੈ ਔਰ ਜਨਤਾ ਉਹਨਾਂ ਨੂੰ ਬਹੁਤ ਖਰੀਦ ਰਹੀ ਹੈ ਅਤੇ ਦੱਸਿਆ ਜਾਂਦਾ ਹੈ ਜਦੋਂ ਉਹ ਲੈਂਦੇ ਹਨ ਕਿ ਸਭ ਤੋਂ ਵਧੀਆ ਭਾਂਡਾ ਹੈ ਅਤੇ ਇਸ ਨੂੰ ਖਰੀਦਣ ਨਾਲ ਜਦੋਂ ਤੁਸੀਂ ਰੋਟੀ ਪਾਣੀ ਬਣਾਓਗੇ ਤਾਂ ਜਮਸ ਘੱਟ ਆਉਣਗੇ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ ਪਿੱਤਲ ਦਾ ਭਾਂਡਾ